ਪੰਜਾਬ ਪੰਜਾਬ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਅਤੇ ਸਮਾਰਕ ਸਮਾਗਮ ਪਰਟੀਕੁਲਰਲੀ ਗੁਰਪੁਰਬ ਹਨ ਸਾਡੇ ਸਾਡਾ ਪੰਜਾਬ ਗੁਰੂਆਂ ਦੀ ਧਰਤੀ ਹੈ ਜਿੱਥੇ ਦਸਾਂ ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ ਹਨ ਉਹਨਾਂ ਦੇ ਸ਼ਹੀਦੀ ਜੋੜ ਮੇਲੇ ਲੱਗਦੇ ਹਨ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦਾ ਵੀ ਗੁਰਪੁਰਬ ਮਨਾਇਆ ਜਾਂਦਾ ਹੈ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਇੱਥੇ ਸਮੇਂ ਦੇ ਮੁਤਾਬਿਕ ਇੰਨਾ ਵਿਕਾਸ ਹੋ ਚੁੱਕਾ ਹੈ ਕਿ ਜਿੱਥੇ ਪਹਿਲਾਂ ਗੁਰਪੁਰਬ ਵਾਲੇ ਦਿਨ ਹਜ਼ਾਰ ਪੰਜ ਹਜ਼ਾਰ ਦਸ ਹਜ਼ਾਰ ਸੰਗਤ ਇਕੱਠੀ ਹੁੰਦੀ ਸੀ ਅੱਜ ਦਸ ਲੱਖ ਸੰਗਤ ਇਕੱਠੀ ਹੁੰਦੀ ਹੈ ਜਗ੍ਹਾ ਜਗ੍ਹਾ 'ਤੇ ਲੰਗਰ ਲਗਾਏ ਜਾਂਦੇ ਹਨ ਲੰਗਰ ਲਗਾਉਣ ਵਾਲਿਆਂ ਦੀ ਕਮੀ ਨਹੀਂ ਲੰਗਰ ਖਾਣ ਵਾਲਿਆਂ ਤੋਂ ਜ਼ਿਆਦਾ ਲੰਗਰ ਲਗਾਉਣ ਵਾਲੇ ਹੁੰਦੇ ਹਨ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਅੱਜ ਕੱਲ੍ਹ ਜਦੋਂ ਗੁਰਪੁਰਬ ਮਨਾਇਆ ਜਾਂਦਾ ਹੈ ਤਾਂ ਕਿੰਨੀ ਸਜਾਵਟ ਕੀਤੀ ਜਾਂਦੀ ਸਜਾਵਟ ਦੇ ਵਿੱਚ ਵੀ ਬਹੁਤ ਬਦਲਾਅ ਆ ਚੁੱਕਾ ਹੈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਚੁੱਕੀਆਂ ਹਨ ਜਿਹਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਗੁਰਦੁਆਰਿਆਂ ਦੀ ਗੁਰ ਨਗਰ ਕੀਰਤਨ ਸਜਾਏ ਜਾਂਦੇ ਹਨ ਪੂਰੇ ਦੇ ਪੂਰੇ ਸ਼ਹਿਰ ਦੇ ਵਿੱਚੋਂ ਨਗਰ ਕੀਰਤਨ ਲੈ ਲੈ ਕੇ ਜਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਹ ਪਤਾ ਚੱਲ ਸਕੇ ਕਿ ਅੱਜ ਸਾਡੇ ਇਸ ਗੁਰੂ ਦਾ ਗੁਰਪੁਰਬ ਹੈ ਆਗਮਨ ਹੈ ਔਰ ਉਹ ਉਸਨੂੰ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ ਆਪਣੀ ਆਪਣੀ ਜਗ੍ਹਾ 'ਤੇ ਹਰ ਇਨਸਾਨ ਜਿਹੜਾ ਹੈ ਉਸਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਵਿਕਾਸ ਹੋ ਚੁੱਕਾ ਹੈ ਇਹਨਾਂ ਨੂੰ ਮਨਾਉਣ ਦੇ ਤਰੀਕਿਆਂ ਦੇ ਵਿੱਚ ਫ਼ਰਕ ਆ ਚੁੱਕਾ ਹੈ ਧੰਨਵਾਦ